ਪੰਜਾਬ 'ਚ ਕਾਰੋਬਾਰ ਦਾ ਸਾਹਮਣਾ ਤਾਂ ਮੁੱਖ ਚੁਣੌਤੀ ਤਾਂ ਇਹ ਹੀ ਹੋ ਹੈ ਕਿ ਇੱਕੋ ਹੀ ਚੀਜ਼ ਦੀ ਬਹੁਤ ਸਾਰੀ ਦੁਕਾਨਾਂ ਹੈ ਬਹੁਤ ਸਾਰੀ ਜਗ੍ਹਾ ਹੈ ਪੈਸਾ ਇੰਨਾ ਲਗਾ ਕੇ ਲੋਕ ਆਪਣਾ ਉਤਪਾਦ ਮਤਲਬ ਸ਼ੁਰੂ ਕਰਦੇ ਆਪਣਾ ਕਾਰੋਬਾਰ ਸ਼ੁਰੂ ਕਰਦੇ ਹੈ ਪਰ ਉਹ ਕਾਰੋਬਾਰ 'ਤੇ ਫਿਰ ਉਹਨਾਂ ਨੂੰ ਓਨਾ ਪੈਸਾ ਮਿਲਦਾ ਨਹੀਂ ਹੈ